ਪੰਜਾਬੀ ਸੱਭਿਆਚਾਰ ਵਿੱਚ ਬਹੁਤ ਸਾਰੇ ਰਸਮ ਰਿਵਾਜ਼ ਅਤੇ ਪਰੰਪਰਾਵਾਂ ਹਨ ਬੱਚੇ ਦੇ ਜਨਮ ਤੋਂ ਲੈ ਕੇ ਮਰਨ ਤੱਕ ਪੰਜਾਬੀ ਸੱਭਿਆਚਾਰ ਵਿੱਚ ਪਰੰਪਰਾਵਾਂ ਅਤੇ ਰੀਤੀ ਰਿਵਾਜ਼ ਚੱਲਦੇ ਹੀ ਰਹਿੰਦੇ ਨੇ ਜਿਵੇਂ ਜਨਮ ਸਮੇਂ ਜੇ ਮੁੰਡਾ ਹੋਣ 'ਤੇ ਬਹੁਤ ਸਾਰੇ ਸ਼ਗਨ ਮਨਾਏ ਜਾਂਦੇ ਨੇ ਜਿਵੇਂ ਨਿੰਮ ਵਗੈਰਾ ਬੰਨਿਆ ਜਾਂਦਾ ਹੈ ਅਤੇ ਹੋਰ ਵੀ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਇਸ ਤਰ੍ਹਾਂ ਹੀ ਵਿਆਹ ਦੇ ਟਾਈਮ ਵਿੱਚ ਮੁੰਡੇ ਦੇ ਵਿਆਹ ਵੇਲੇ ਘੋੜੀਆਂ ਗਾਈਆਂ ਜਾਂਦੀਆਂ ਨੇ ਕੁੜੀ ਦੇ ਵਿਆਹ ਵੇਲੇ ਸੁਹਾਗ ਸੁਹਾਗ ਗਾਏ ਜਾਂਦੇ ਨੇ ਇਸ ਤਰ੍ਹਾਂ ਹੀ ਹੱਸਣ ਨੱਚਣ ਦਾ ਮਾਹੌਲ ਜਿਹੜਾ ਉਹ ਵਿਆਹ ਸਮੇਂ ਬਣਾਇਆ ਜਾਂਦਾ ਵਿਆਹ ਵਿਆਹ ਵਿੱਚ ਪੰਜਾਬੀ ਪੰਜਾਬੀ ਪ ਪੰਜਾਬ ਵਿੱਚ ਵਿਆਹ ਵਿਆਹ ਲਾਵਾਂ ਫੇਰਿਆਂ ਅਤੇ ਆਨੰਦ ਕਾਰਜ ਵਗੈਰਾ ਨਾਲ ਚਲਦੇ ਨੇ ਇਸ ਤਰ੍ਹਾਂ ਹੀ ਮੌਤ ਸਮੇਂ ਅਲਾਹੁਣੀਆਂ ਅਲਾਹੁਣੀਆਂ ਪਾਈਆਂ ਜਾਂਦੀਆਂ ਹਨ ਪਰ ਮੈਨੂੰ ਅੱਜ ਪਰ ਅੱਜ ਕੱਲ ਦਾ ਸਮਾਜ ਆ ਜਿਹੜਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਉਹ ਦਿਨੋਂ ਦਿਨ ਤਬਦੀਲ ਹੋ ਰਿਹਾ ਹੈ ਜਿਵੇਂ ਕਿ ਅੱਜ ਕੱਲ ਮੁੰਡਿਆਂ ਦੀ ਲੋਹੜੀ ਦੇ ਨਾਲ ਨਾਲ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ ਜਿਵੇਂ ਮੁੰਡਿਆਂ ਦੇ ਵਿਆਹ 'ਤੇ ਜਾਗੋ ਕੱਢੀ ਸੀ ਅੱਜ ਕੱਲ ਕੁੜੀਆਂ ਦੇ ਵਿਆਹ ਨੂੰ ਵੀ ਉੱਦਾਂ ਹੀ ਮਨਾਇਆ ਜਾਂਦਾ ਹੈ ਉੱਦਾਂ ਹੀ ਜਾਗੋ ਕੱਢੀ ਜਾਂਦੀ ਅਤੇ ਸੈਲੀਬਰੇਟ ਕੀਤਾ ਜਾਂਦਾ ਹੈ ਇਸ ਤਰ੍ਹਾਂ ਮੈਨੂੰ ਇਹ ਜਿ ਜਿਹੜਾ ਰੀਤੀ ਰਿਵਾਜ਼ ਆਪਣਾ ਬਦਲਦਾ ਪੰਜਾਬੀ ਦਾ ਬਦਲਦਾ ਨਜ਼ਰੀਆ ਇਹ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਜਿਸ ਵਿੱਚ ਕੁੜੀ ਅਤੇ ਮੁੰਡੇ ਨੂੰ ਬਰਾਬਰ ਸਮਝਿਆ ਜਾਂਦਾ ਹੈ